ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹੁਕਮ ਕਰੋ ਹਾਂਜੀ ਹੁਕਮ ਕਰੋ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਬੋਲੋ ਹੈਲੋ ਹਾਂਜੀ ਦੱਸੋ ਠੀਕ ਠੀਕ ਹੈ ਮੈਂ ਤੁਹਾਨੂੰ ਇਹਦੀ ਇਫ ਇਨਫਾਟਕਚਰ ਬਾਰੇ ਦੱਸਦਾ ਠੀਕ ਹੈ ਜੀ ਇਹ ਨਾ ਇਹ ਨਾ ਸਾਢੇ ਪੰਜ ਸੌ ਕਿੱਲੇ 'ਚ ਬਣੀ ਹੋਈ ਹੈ ਜੀ ਠੀਕ ਹੈ ਅਤੇ ਵਿਲੇਜ ਘੁੱਡੇ ਬਣੀ ਹੋਈ ਹੈ ਇਹ ਤਾਂ ਸਿਟੀ ਇਹਨੂੰ ਪੈਂਦਾ ਬਠਿੰਡਾ ਠੀਕ ਹੈ ਜੀ ਵਿਲੇਜ ਘੁੱਡਾ ਅਤੇ ਇਹ ਸਾਢੇ ਪੰਜ ਸੌ ਕਿੱਲੇ 'ਚ ਬਣੀ ਹੋਈ ਹੈ ਇਹ ਦਾ ਐਡਨ ਬਲੋਕ ਬਣਿਆ ਹੋਇਆ ਠੀਕ ਹੈ ਜੀ ਅਤੇ ਉਹਦੇ ਵਿੱਚ ਸਾਰੀਆਂ ਸ਼ਾਨਦਾਰ ਜਿਹੜੀਆਂ ਲੈਬ ਲੈਬਸ ਨੇ ਲੈਬਸ ਬਣੀਆਂ ਹੋਈਆਂ ਨੇ ਘੱਟ ਤੋਂ ਘੱਟ ਦੋ ਸੌ ਤੋਂ ਉੱਤੇ ਠੀਕ ਹੈ ਅਤੇ ਹਰ ਲੈਬ ਏ ਸੀ ਲੈਬ ਹੈ ਠੀਕ ਹੈ ਜੀ ਅਤੇ ਬਕਾਇਦਾ ਇਹਦੇ ਚਾਰ ਹੋਸਟਲ ਨੇ ਠੀਕ ਹੈ ਜੀ ਦੋ ਆਪਣਾ ਇਕ ਮਾਸਟਰ ਅਤੇ ਇੱਕ ਪੀ ਐੱਚ ਡੀ ਬੋਇਜ਼ ਅਤੇ ਇੱਕ ਮਾਸਟਰ ਕੁੜੀ ਅ ਗਰਲ ਅਤੇ ਇੱਕ ਪੀ ਐੱਚ ਡੀ ਗਰਲ ਠੀਕ ਹੈ ਜੀ ਚਾਰ ਹੋਸਟਲ ਨੇ ਟੋਟਲ ਯਾਣੀ ਕਿ ਦੋ ਮਾਸਟਰ ਦੋ ਪੀ ਐੱਚ ਡੀ ਠੀਕ ਹੈ ਜੀ ਅਤੇ ਫਿਰ ਇਨਫੋਟਕਚਰ ਆਪਾਂ ਹੋਰ ਗੱਲ ਕਰੀਏ ਇੱਕ ਟ੍ਰਾਂਜੈੱਟ ਹੈ ਜੀ ਇੱਧਰ ਠੀਕ ਹੈ ਟ੍ਰਾਂਜੈੱਟ ਹੈ ਅਤੇ ਇੱਕ ਗੈਸਟ ਹਾਊਸ ਹੈ ਠੀਕ ਹੈ ਜੀ ਉਹਦੇ ਨਾਲ ਨਾਲ ਉਹਦੇ ਮੈਂਗੋ ਗਾਰਡਨ ਹੈ ਮੈਂਗੋ ਗਾਰਡਨ ਦੇ ਨਾਲ ਆਪਣੇ ਇੱਕ ਰੋਜ਼ ਗਾਰਡਨ ਵੀ ਹੈ ਅਤੇ ਹਾਲੇ ਹੀ ਹੁਣ ਹੀ ਥੋੜ੍ਹਾ ਟਾਈਮ ਹੀ ਹੋਇਆ ਅਤੇ ਐਡਮਿਨਿਸਟ੍ਰੇਸ਼ਨ ਦੇ ਐਡਮਿਨ ਬਲੋਕ ਦੇ ਪਿਛਲੇ ਪਾਸੇ ਐਡਮਿਨਿਸਟ੍ਰੇਸ਼ਨ ਵੀ ਬਣ ਰਿਹਾ ਅਤੇ ਆਪਣਾ ਲਾਇਬਰੇਰੀ ਵੀ ਬਣ ਰਹੀ ਹੈ ਠੀਕ ਹੈ ਜੀ ਹਾਂ ਅਤੇ ਇਹ ਯੂਨੀਵਰਸਿਟੀ ਦੇ ਤਿੰਨ ਦਰਵਾਜ਼ੇ ਨੇ ਠੀਕ ਹੈ ਜੀ ਜਿਹੜੇ ਜਿਹੜੇ ਤਾਂ ਇੱਕ ਬਾਦਲ ਰੋਡ ਦੇ ਉੱਤੇ ਨਿਕਲਦਾ ਆਪਣੇ ਆਹ ਪ ਘੁੱਡਾ ਬਾਦਲ ਰੋਡ ਦੇ ਉੱਤੇ ਨਿਕਲਦਾ ਅਤੇ ਦੋ ਗੇਟ ਇਹਦੇ ਝੂੰਬੇ ਕਨੀ ਨਿਕਲਦੇ ਨੇ ਜਿਹੜਾ ਝੁੰਬਾ ਪਿਛ ਪਿਛਲੇ ਪਾਸੇ ਪਿੰਡ ਪੈਂਦਾ ਯੂਨੀਵਰਸਿਟੀ ਦੇ ਅਤੇ ਇਹ ਉੱਧਰ ਨਿਕਲਦੇ ਨੇ ਦੋ ਗੇਟ ਠੀਕ ਹੈ ਜੀ ਹੋਸਟਲ ਦੇ ਵਿੱਚ ਘੱਟੋ ਘੱਟ ਹੈਗੇ ਜੀ ਦੋ ਢਾਈ ਸੌ ਦੇ ਵਿੱਚ ਕਰੀਬ ਰੂਮ ਹੁੰਦਾ ਹਾਂਜੀ ਹਾਂ ਅਤੇ ਇੱਕ ਉਹ ਇੱਕ ਰੂਮ ਦੇ ਵਿੱਚ ਦੋ ਦੋ ਬੱਚੇ ਰਹਿੰਦੇ ਨੇ ਅਤੇ ਚਾਰ ਹੋਸਟਲ ਨੇ ਜੀ ਦੋ ਮਾਸਟਰ ਵਾਸਤੇ ਅਤੇ ਦੋ ਪੀ ਐੱਚ ਡੀ ਵਾਸਤੇ ਹਾਂਜੀ ਹਾਂ